ਹੈਲੋ ਹ ਹਾਂਜੀ ਮੈਮ ਤੁਸੀਂ ਪਾਸਪੋਰਟ ਆਫਿਸ ਤੋਂ ਬੋਲ ਰਹੇ ਹੋ ਹਾਂਜੀ ਪਾਸਪੋਰਟ ਬਾਰੇ ਥੋੜ੍ਹਾ ਜਿਹਾ ਪੂਛ ਤਾਸ਼ ਕਰਨੀ ਸੀਗੀ ਕਿ ਕਿਵੇਂ ਇਨਕੁਆਇਰੀ ਕਰਨੀ ਸੀਗੀ ਕਿ ਕਿਵੇਂ ਬਣਦਾ ਹੈ ਕਿ ਇੱਥੇ ਆਪਣੇ ਪੰਜਾਬ ਵਿੱਚ ਕਿਹੜੀ ਕਿਹੜੀ ਸਿਟੀਜ਼ ਜਾਂ ਡਿਸਟ੍ਰਿਕਟ 'ਚ ਬਣਦਾ ਹਾਂਜੀ ਹਾਂ ਜੀ ਮੈਂ ਤਾਂ ਫਰੀਦਕੋਟ ਤੋਂ ਬੋਲਦੀ ਹਾਂ

ਅੱਛਾ ਅੱਛਾ ਅੱਛਾ ਅੱਛਾ ਜਿਹੜੇ ਆਪਣੇ ਮਤਲਬ ਆਮ ਜਿਹੜੇ ਜਿੱਥੇ ਕੰਮ ਹੁੰਦੇ ਨੇ ਫੋਟੋਸ਼ੋਪ ਵਾਲੀਆਂ ਕੋਪੀਆਂ ਠੀਕ ਆ ਠੀਕ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਇਨਕੁਆਇਰੀ ਕਰੇਗੀ ਅੱਛਾ ਅੱਛਾ ਗੁਆਂਢੀ ਮਤਲਬ ਕਿ ਮੇਰੇ ਜਿਹੜੇ ਘਰ ਦੇ ਨਾਲ ਜੋ ਰਹਿੰਦੇ ਹੋਣ ਉਹ ਵੀ ਅੱਛਾ ਅੱਛਾ ਮਤਲਬ ਮੇਰੇ ਫਰੀਦਕੋਟ ਦੇ ਹੋਣੇ ਚਾਹੀਦੇ ਆ ਮਤਲਬ ਫਰੀਦਕੋਟ ਦੇ ਅੱਛਾ ਅੱਛਾ ਹੋਰ ਕੋਈ ਡਾਕੂਮੈਂਟ ਤਾਂ ਨਹੀਂ ਲੱਗਣਾ ਇਨਕੁਇਰੀ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਕੀ ਕੁਝ ਖਰਚਾ ਆ ਜਾਂਦਾ ਆਪਣਾ ਜੇ ਆਪਾਂ ਅੰਮ੍ਰਿਤਸਰ ਤੋਂ ਅਪਲਾਈ ਕਰੀਏ ਉੱਧਰੋਂ ਕਰੀਏ ਤਾਂ ਅੱਛਾ ਅੱਛਾ ਕੋਈ ਖਤਰੇ ਵਾਲਾ ਕੰਮ ਤਾਂ ਨੀਗਾ ਜਿਵੇਂ ਆਪਾਂ ਪਾਸਪੋਰਟ ਵਗੈਰਾ ਅਪਲਾਈ ਕਰੀਏ ਤਾਂ ਓਕੇ ਓਕੇ ਹਾਂਜੀ ਹਾਂਜੀ ਅਤੇ ਹੋਰ ਹੋਰ ਕੁਛ ਇਨਕੁਆਇਰੀ ਜੇ ਕੁਝ ਦੇਣੀ ਹੋਵੇ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਚਾਹੀਦਾ ਹੈ ਕਿ ਵੀਹ ਪੱਚੀ ਦਿਨ ਜੇ ਲੰਘ ਲੱਗ ਜਾਣਗੇ ਤਾਂ ਕੋਈ ਦਿੱਕਤ ਨਹੀਂ ਵੈਸੇ ਵੀਹ ਪੱਚੀ ਦਿਨ 'ਚ ਹੋ ਜਾਵੇ ਸਾਡਾ ਵੈਸੇ ਕਿੰਨਾ ਕੁ ਟਾਈਮ ਲੱਗਦਾ ਵੈਸੇ ਕਿੰਨਾ ਟਾਈਮ ਲੱਗਦਾ ਪਾਸਪੋਰਟ ਬਣਨ 'ਚ ਅੱਛਾ ਅੱਛਾ ਅੱਛਾ ਅੱਛਾ ਤਾਂ ਮਤਲਬ ਕਿ ਸਾਨੂੰ ਫਿਰ ਦੋ ਤਿੰਨ ਮਹੀਨਿਆਂ ਵੇਟ ਕਰਨਾ ਪਊਗਾ ਅੱਛਾ ਅੱਛਾ ਠੀਕ ਹੈ